ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਤੋਂ ਲੈਪਟੋਪ ਆਰਡਰ ਕਰਿਆ ਸੀ ਤੁਸੀਂ ਮੈਨੂੰ ਕਿਹਾ ਸੀ ਵੀ ਲੈਪਟੋਪ ਤੁਹਾਡਾ ਦਸ ਦਿਨਾਂ ਦੇ ਅੰਦਰ ਅੰਦਰ ਪਹੁੰਚ ਜੂਗਾ ਅਤੇ ਅੱਜ ਲੈਪਟੋਪ ਮੈਨੂੰ ਅਠਾਰਵੇਂ ਦਿਨ ਜਾ ਕੇ ਮਿਲਿਆ ਹੈ ਅਤੇ ਇਸ ਜਦੋਂ ਇਹ ਮਿਲਿਆ ਅਤੇ ਇਸਦੀ ਪੈਕਿੰਗ ਜਦੋ ਮੈਂ ਦੇਖੀ ਬਹੁਤ ਹੀ ਹੈਰਾਨੀ ਹੋਈ ਇਸਦੀ ਪੈਕਿੰਗ ਨੂੰ ਦੇਖ ਕੇ ਫਟੀ ਹੋਈ ਪੈਕਿੰਗ ਸੀ ਅਤੇ ਜਦੋਂ ਮੈਂ ਲੈਪਟੋਪ ਨੂੰ ਖੋਲ੍ਹਿਆ ਪਹਿਲਾਂ ਤਾਂ ਇਹ ਸਟਾਰਟ ਹੀ ਨਹੀਂ ਹੋਇਆ ਤੁਸੀਂ ਮੈਨੂੰ ਕਿਹਾ ਸੀ ਵੀ ਤੁਹਾਡੀ ਕੰਪਨੀ ਦਾ ਬੰਦਾ ਆਵੇਗਾ ਉਹ ਲੈਪਟੋਪ ਦੇ ਸਾਰੇ ਫਿਚਰਜ਼ ਸਮਝਾ ਕੇ ਜਾਵੇਗਾ ਉਸਨੇ ਮੈਨੂੰ ਕੁਛ ਨਹੀਂ ਦੱਸਿਆ ਲੈਪਟੋਪ ਫੜਾਇਆ ਅਤੇ ਆਪਣੀ ਰਹਿੰਦੀ ਹੋਈ ਰਕਮ ਨੂੰ ਲੈ ਕੇ ਚਲਦਾ ਬਣਿਆ ਜਦੋਂ ਮੈਂ ਲੈਪਟੋਪ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਇਹ ਬਹੁਤ ਹੀ ਮੁਸ਼ਕਿਲ ਅੱਧਾ ਘੰਟਾ ਲੈ ਕੇ ਤਾਂ ਤਾਂ ਇਹ ਸਟਾਰਟ ਹੋਇਆ ਉਸ ਤੋਂ ਬਾਅਦ ਇਸਦੀ ਜੋ ਕੇਬਲ ਸੀ ਉਹ ਵੀ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਜਦੋਂ ਇਹਨੂੰ ਮੈਂ ਸਾਰਾ ਖੋਲ੍ਹ ਕੇ ਚਲਾਇਆ ਤਾਂ ਮੈਨੂੰ ਬਹੁਤ ਹੀ ਦਿੱਕਤਾਂ ਆਈਆਂ ਇਹਨੂੰ ਚਲਾਉਣ ਵਿੱਚ ਤੁਹਾਡੀ ਮੈਨੂੰ ਤੁਹਾਡੀ ਕੰਪਨੀ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਤੁਹਾਡਾ ਬਹੁਤ ਹੀ ਵਧੀਆ ਨਾਮ ਸੁਣਿਆ ਹੋਇਆ ਸੀ ਪਰ ਮੈਂ ਤੁਹਾਡੀ ਕੰਪਨੀ ਦਾ ਲੈਪਟੋਪ ਲੈ ਕੇ ਬਹੁਤ ਨਿਰਾਸ਼ ਹੋਇਆ ਹਾਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਹੈ ਤੁਹਾਡੀ ਕੰਪਨੀ ਦਾ ਜਿੱਦਾਂ ਦਾ ਵਿਊ ਮੈਨੂੰ ਮਿਲਿਆ ਹੈ